ਸਤਿ ਸ਼੍ਰੀ ਅਕਾਲ ਜੋਤੀ ਸਾਰੀ ਨਮਸਤੇ ਸਰ ਸਰ ਅ ਕੱਲ੍ਹ ਤੁਹਾਡੇ ਸਟਾਫ ਮੈਂਬਰ ਨੇ ਮੈਨੂੰ ਸ਼ਾਮ ਨੂੰ ਕੌਲ ਕੀਤੀ ਸੀ ਮੈਂ ਥੋੜ੍ਹਾ ਬਿਜ਼ੀ ਸੀਗੀ ਅਤੇ ਇਸ ਕਰਕੇ ਮੈਂ ਕੌਲ ਬੈਕ ਨਹੀਂ ਕਰ ਪਾਈ ਅਤੇ ਮੈਂ ਸੋਚਿਆ ਅੱਜ ਮੈਂ ਕੌਲ ਕਰ ਲਵਾਂ ਅਤੇ ਜਿੱਦਾਂ ਕਿ ਉਹਨਾਂ ਨੇ ਕੌਲ ਕੀਤੀ ਸੀਗੀ ਮੈਨੂੰ ਰੀਵਿਊ ਪੁੱਛਣ ਲਈ ਪ੍ਰੋਡਕਟ ਦਾ ਮੈਂ ਹਫ਼ਤਾ ਪਹਿਲੇ ਸਾੜੀ ਮੰਗਵਾਈ ਸੀਗੀ ਮੇਰੀ ਕਜ਼ਨ ਦੀ ਮੈਰਿਜ ਲਈ ਅਤੇ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਮੈਨੂੰ ਬਹੁਤ ਜ਼ਿਆਦਾ ਡਾਊਟ ਸੀਗਾ ਜਦੋਂ ਮੈਂ ਸਾੜੀ ਔਡਰ ਕਰ ਰਹੀ ਸੀਗੀ ਥੋੜ੍ਹਾ ਓਵਰ ਪ੍ਰਾਈਜਡ ਅਤੇ ਮੈਨੂੰ ਲੱਗ ਰਹੀ ਸੀਗੀ ਕਿ ਹਾਂ ਮੈਂ ਦੋ ਹਜ਼ਾਰ ਦੋ ਹਜ਼ਾਰ ਸਾੜੀ ਦਾ ਦੇ ਰਹੀ ਹਾਂ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਲੱਗ ਰਿਹਾ ਸੀਗਾ ਬਟ ਜਦੋਂ ਮੇਰੀ ਸਾੜੀ ਆਈ ਮੈਂ ਸਟਿੱਚ ਕਰਵਾਈ ਤਾਂ ਉਹ ਇੰਨੀ ਸੋਹਣੀ ਨਿਕਲ ਕੇ ਆਈ ਕਿ ਸਾਰਿਆਂ ਨੇ ਮਤਲਬ ਵਿਆਹ 'ਤੇ ਮੇਰੀ ਕਜ਼ਨ ਦੇ ਵਿਆਹ 'ਤੇ ਸਾਰਿਆਂ ਨੇ ਬਹੁਤ ਜ਼ਿਆਦਾ ਤਾਰੀਫ਼ ਕੀਤੀ ਮੇਰੀ ਛੋਟੀ ਭੈਣ ਦਾ ਵਿਆਹ ਸੀਗਾ ਅਤੇ ਸਭ ਨੇ ਮੇਰੀ ਸਾੜੀ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਬਹੁਤ ਜ਼ਿਆਦਾ ਅਤੇ ਮੇਰੇ ਸਸੁਰਾਲ ਵਾਲਿਆਂ ਨੇ ਵੀ ਮੇਰੀ ਸਾੜੀ ਬਹੁਤ ਪਸੰਦ ਕੀਤੀ ਅਤੇ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਕਿ ਤੁਹਾਡਾ ਸਾੜੀ ਦਾ ਜਿਹੜਾ ਮਤਲਬ ਜੋ ਉਹਦਾ ਫੈਬਰਿਕ ਸੀਗਾ ਜੋ ਉਹਦਾ ਕੱਪੜਾ ਸੀਗਾ ਇੰਨਾ ਸੋਹਣਾ ਸੀਗਾ ਇੰਨਾ ਜ਼ਿਆਦਾ ਮਤਲਬ ਉਹਨੂੰ ਮੇਰੇ ਮੇਰੇ ਲਈ ਮਲਾਮਦਾਇਕ ਸੀਗਾ ਕੰਫਰਟੇਬਲ ਸੀਗਾ ਅਤੇ ਮੈਨੂੰ ਬਹੁਤ ਮਤਲਬ ਹੰਡਰਡ ਔਨ ਹੰਡਰਡ ਵੀ ਜੇ ਮੈਂ ਦੇਵਾਂ ਤਾਂ ਉਹ ਸਾੜੀ ਨੂੰ ਘੱਟ ਸੀਗੇ ਦੋ ਹਜ਼ਾਰ ਦੇ ਅਕੋਰਡਿੰਗ ਪਹਿਲਾਂ ਮੈਨੂੰ ਓਵਰ ਪ੍ਰਾਈਜ਼ ਲੱਗ ਰਿਹਾ ਸੀਗਾ ਕਿਉਂਕਿ ਇੰਸਟਾ ਤੋਂ ਅਸੀਂ ਜਦੋਂ ਦੇਖਦੇ ਹਾਂ ਤਾਂ ਥੋੜ੍ਹਾ ਡਾਊਟ ਜਿਹਾ ਹੋ ਜਾਂਦਾ ਹੈ ਨਾ ਕਿ ਪ੍ਰੋਡਕਟ ਪਤਾ ਨਹੀਂ ਕਿੱਦਾਂ ਦਾ ਹੋਊਗਾ ਜਾਂ ਕਿੱਦਾਂ ਦਾ ਆਊਗਾ ਬਟ ਹਾਂ ਜਦੋਂ ਸਾੜੀ ਮੇਰੀ ਆਈ ਮੈਨੂੰ ਬਹੁਤ ਸੈਟੀਸਫੈਕਸ਼ਨ ਹੋਈ ਮੈਂ ਮੈਂ ਕੰਪਲੀਟਲੀ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਮਤਲਬ ਮੈਨੂੰ ਵਧੀਆ ਲੱਗਾ ਮੈਂ ਨੈਕਸਟ ਟਾਈਮ ਹੁਣ ਖੁਦ ਦੇ ਸ਼ੌਪ 'ਤੇ ਵਿਜਿਟ ਕਰੂੰਗੀ ਜਦੋਂ ਆਉਂਗੀ ਅਤੇ ਮੈਂ ਕਾਫੀ ਸਾਰੇ ਪ੍ਰੋਡਕਟਸ ਤੁਹਾਡੇ ਕੋਲ ਮਤਲਬ ਕਿਸੇ ਨੂੰ ਨਾਲ ਲੈ ਕੇ ਜ਼ਰੂਰ ਆਉਂਗੀ ਕੱਪੜੇ ਲੈਣ ਲਈ ਤੁਹਾਡੇ ਮੈਂ ਦੇਖੇ ਸੀਗੇ ਇੰਸਟਾ 'ਤੇ ਹੋਰ ਵੀ ਬਹੁਤ ਸਾਰੇ ਤੁਸੀਂ ਪਾਏ ਹੋਏ ਸੀਗੇ ਨਵੇਂ ਨਵੇਂ ਸਾੜੀਜ਼ ਵੀ ਸੂਟ ਵੀ ਅਤੇ ਮੈਂ ਜਦੋਂ ਵੀ ਆਈ ਤਾਂ ਮੈਂ ਜ਼ਰੂਰ ਲੈ ਕੇ ਆਉਂਗੀ ਅਤੇ ਪਲੱਸ ਹਾਂ ਤੁਹਾਡੇ ਸਟਾਫ ਮੈਂਬਰ ਨੇ ਮੈਨੂੰ ਕਿਹਾ ਸੀਗਾ ਕਿ ਗੂਗਲ 'ਤੇ ਰੀਵਿਊ ਕਰਨ ਲਈ ਅਤੇ ਮੈਂ ਉਹ ਵੀ ਜ਼ਰੂਰ ਕਰ ਦਾਂਗੀ ਬਟ ਮੇਰਾ ਮੇਰਾ ਜੋ ਐਕਸਪੀਰੀਅਸ ਸੀਗਾ ਅਤੇ ਮੈਂ ਸੋਚਿਆ ਮੈਂ ਤੁਹਾਨੂੰ ਫੋਨ ਕਰਕੇ ਪਹਿਲੇ ਦੱਸਾਂ ਕਿਉਂਕਿ ਉਹ ਜ਼ਰੂਰੀ ਹੁੰਦਾ ਹੈ ਨਾ ਕਿਸੇ ਲਈ ਵੀ ਉਹਦਾ ਕਿ ਉਹਨੂੰ ਵਧੀਆ ਲੱਗੇ ਉਹਨਾਂ ਦਾ ਪ੍ਰੋਡਕਟ ਵਧੀਆ ਅਤੇ ਵਧੀਆ ਲੱਗੇ ਇਸ ਕਰਕੇ ਮੈਂ ਹਾਂ ਇੰਸਟਾ 'ਤੇ ਵੀ ਰਿਵਿਊ ਦੇ ਦੂੰਗੀ ਅਤੇ ਮੈਂ ਜ਼ਰੂਰ ਤੁਹਾਡਾ ਗੂਗਲ 'ਤੇ ਵੀ ਰਿਵਿਊ ਦਉਂਗੀ ਕਿਉਂਕਿ ਮੈਨੂੰ ਸਾੜੀ ਇੰਨੀ ਪਸੰਦ ਆਈ ਹੈ ਨਾ ਮੈਂ ਬਹੁਤ ਜ਼ਿਆਦਾ ਹੰਡਰਡ ਐਂਡ ਟੈਨ ਪਰਸੈਂਟ ਖੁਸ਼ ਹਾਂ ਬਹੁਤ ਵਧੀਆ ਮਤਲਬ ਸੌ 'ਚੋਂ ਸੌ ਨੰਬਰ ਹੈ ਤੁਹਾਡੀ ਸਾੜੀ ਨੂੰ